ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਮੈਂ ਤੁਹਾਡੇ ਸਾਰਿਆਂ ਦੇ ਨਾਲ ਗੱਲ ਕਰਨ ਜਾ ਰਿਹਾ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਵੱਖ ਵੱਖ ਖੇਤਰਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੀ ਜਿਹੜੀ ਉਹ ਖੇਤੀ ਜਿਹੜੀ ਆ ਉਹ ਕੀਤੀ ਜਾਂਦੀ ਆ ਪਰ ਜਿਹਦੇ ਕਈ ਤਰ੍ਹਾਂ ਦੀਆਂ ਖੇਤੀ ਜਿਹੜੀ ਕੀਤੀ ਜਾਂਦੀ ਉਹਨਾਂ ਵਿੱਚੋਂ ਆ ਜਾਂਦੀ ਆ ਝੋਨਾ ਕਣਕ ਗੰਨੇ ਦੀ ਖੇਤੀ ਕਈ ਦਾਲਾਂ ਦੀ ਖੇਤੀ ਇਹਨਾਂ ਵਿੱਚੋਂ ਹਰ ਇੱਕ ਦੀ ਜਿਹੜੀ ਆ ਉਹਨਾਂ ਦੀ ਆਪਣੀ ਜਿਹੜੀ ਆ ਉਹ ਮਹੱਤਤਾ ਵਾ ਜਿਹਦੇ ਵਿੱਚ ਗੰਨੇ ਦੀ ਜਿਹੜੀ ਆ ਯੀਲਡਿੰਗ ਦੇ ਜਿਹੜਾ ਵਾ ਉਹ ਬਹੁਤ ਹੀ ਵਧੀਆ ਜਿਹੜਾ ਵਾ ਉਹ ਪ੍ਰੋਫਿਟ ਜਿਹੜਾ ਵਾ ਮੁਨਾਫਾ ਜਿਹੜਾ ਬਹੁਤ ਹੀ ਵਧੀਆ ਛੱਡ ਕੇ ਜਾਂਦੀ ਆ ਪਰ ਇਹਦਾ ਜਿਹੜਾ ਸਮਾਂ ਜਿਹੜਾ ਵਾ ਉਹ ਇੱਕ ਸਾਲ ਦਾ ਹੁੰਦਾ ਵਾ ਜੇ ਤਾਂ ਗੱਲ ਕਰੀਏ ਅਸੀਂ ਕਣਕ ਅਤੇ ਝ ਝੋਨੇ ਦੀ ਅਤੇ ਉਹਦਾ ਜਿਹੜਾ ਸਮਾਂ ਜਿਹੜਾ ਵਾ ਉਹ ਛੇ ਮਹੀਨੇ ਦਾ ਹੁੰਦਾ ਵਾ ਛੇ ਮਹੀਨੇ ਵਿੱਚ ਕਣਕ ਤਿਆਰ ਹੋ ਜਾਂਦੀ ਛੇ ਮਹੀਨੇ ਵਿੱਚ ਹੀ ਝੋਨਾ ਤਿਆਰ ਹੋ ਜਾਂਦਾ ਵਾ ਇਹ ਬਹੁਤ ਹੀ ਵਧੀਆ ਪ੍ਰੋਫਿਟ ਮੁਨਾਫਾ ਛੱਡ ਕੇ ਜਾਂਦੀ ਆ ਕਿਸਾਨਾਂ ਦੇ ਲਈ ਪਰ ਹਰ ਵਾਰ ਹਰ ਸਾਲ ਜੇਕਰ ਅਸੀਂ ਇੱਕੋ ਹੀ ਜਗ੍ਹਾ 'ਤੇ ਇੱਕ ਹੀ ਸਥਾਨ 'ਤੇ ਵਾਰ ਵਾਰ ਉਹੀ ਖੇਤੀ ਜਦੋਂ ਅਸੀਂ ਕਰੀ ਜਾਂਦੇ ਹਾਂ ਤਾਂ ਉਸ ਜਗ੍ਹਾ ਦੀ ਜਿਹੜੀ ਆ ਉਹ ਜਿਹੜੇ ਵੀ ਉੱਥੇ ਜਿਹੜੇ ਆ ਪੌਸ਼ਟਿਕ ਤੱਤ ਹੁੰਦੇ ਆ ਜਿਹੜੇ ਉਹ ਸਾਰੇ ਜਿਹੜੇ ਉੱਥੇ ਉਹ ਮਰ ਜਾਂਦੇ ਆ ਇਸ ਲਈ ਸਰਕਾਰਾਂ ਵੀ ਕਿਸੇ ਵੇਲੇ ਕਹਿੰਦੀਆਂ ਵੀ ਜਿਹੜੀ ਆ ਉਹ ਇੱਕੋ ਜਗ੍ਹਾ 'ਤੇ ਇੱਕੋ ਕਰੋਪ ਵਾਰ ਵਾਰ ਜਿਹੜੀ ਆ ਉਹ ਨਾ ਉਗਾਈ ਜਾਵੇ ਕਿਉਂਕਿ ਇਹਦੇ ਨਾਲ ਜਿਹੜੀ ਆ ਜ਼ਮੀਨ ਜਿਹੜੀ ਆ ਉਹ ਬੰਜਰ ਹੋ ਜਾਂਦੀ ਆ ਵਾਰ ਵਾਰ ਇੱਕੋ ਉਹ ਜਦੋਂ ਅਸੀਂ ਕਰੋਪ ਉਗਾਉਂਦੇ ਹਾਂ ਜਿੱਦਾਂ ਕਰੋਪ ਦੇ ਵਿੱਚ ਮੈਂ ਗੱਲ ਕਰ ਰਿਹਾ ਇਸ ਟਾਈਮ ਝੋਨਾ ਅਤੇ ਕਣਕ ਦੀ ਗੱਲ ਕਰ ਰਿਹਾ ਮੈਂ ਉਹ ਵਾਰ ਵਾਰ ਉਗਾਉਣ ਦੇ ਨਾਲ ਜਿਹੜੀ ਆ ਉਹ ਜਿਹੜੀ ਆ ਆਊਟਪੁੱਟ ਜਿਹੜੀ ਆ ਉਹ ਐਡੀ ਵਧੀਆ ਜਿਹੜੀ ਆ ਦੇਖਣ ਜੋਗੀ ਨਹੀਂ ਗੀ ਮਿਲਦੀ ਇਸ ਲਈ ਸਾਨੂੰ ਜਿਹੜੀ ਆ ਉਹ ਵੱਖ ਵੱਖ ਤਰ੍ਹਾਂ ਦੀਆਂ ਉਹ ਵਰਾਇਟੀਆਂ ਜਿਹੜੀਆਂ ਵਾ ਆਪਣੀ ਜ਼ਮੀਨ ਦੇ ਉੱਤੇ ਉਗਾਉਣੀਆਂ ਚਾਹੀਦੀਆਂ ਵਾ ਤਾਂ ਜੋ ਸਾਨੂੰ ਬਹੁਤ ਹੀ ਵਧੀਆ ਪ੍ਰੋਫਿਟ ਜਿਹੜਾ ਵਾ ਉਹ ਦੇਖਣ ਨੂੰ ਮਿਲੇ